ਹੈਲੋ ਹਾਂਜੀ ਹਾਂ ਮੈਡਮ ਉਹ ਉਹ ਮਹੂਰਤ ਨਿਕਲਿਆ ਗਿਆਰ੍ਹਾਂ ਅਤੇ ਬਾਰ੍ਹਾਂ ਦਾ ਆਪਾਂ ਗਿਆਰ੍ਹਾਂ ਨੂੰ ਸ਼ਿਫਟ ਕਰ ਲਈਏ ਮੇਰਾ ਖਿਆਲ ਏਕਾਦਸ਼ੀ ਹੈ ਦਿਨ ਵੀ ਵਧੀਆ ਹੈਗਾ ਮਹੂਰਤ ਹੈਗਾ ਨੌਂ ਚਾਲ੍ਹੀ ਤੋਂ ਪਹਿਲੇ ਪਹਿਲੇ ਠੀਕ ਰਹੇਗਾ ਏਕਾਦਸ਼ੀ ਦਾ ਤੇਰਾ ਵੀ ਵਰਤ ਹੁੰਦਾ ਅਤੇ ਬ੍ਰਾਹਮਣਾਂ ਦਾ ਵੀ ਵਰਤ ਹੁੰਦਾ ਫਿਰ ਕਿਵੇਂ ਕਰਾਂਗੇ ਅੱਛਾ ਅੱਛਾ ਕਿੰਨੇ ਕਿੰਨੇ ਕੁ ਬ੍ਰਾਹਮਣ ਬੁਲ ਕਿੰਨੇ ਕ ਬ੍ਰਾਹਮਣ ਬੁਲਾ ਲਈਏ ਪੰਜ ਨਾ ਬੜੇ ਹੋਣਗੇ ਇੰਨਾਂ ਪੈਸਾ ਮਕਾਨ 'ਤੇ ਲੱਗਿਆ ਅਤੇ ਬ੍ਰਾਹਮਣਾਂ ਵੇਲੇ ਪੰਜ ਬੜੇ ਹੋਣਗੇ ਗਿਆਰ੍ਹਾਂ ਪੰਦਰ੍ਹਾਂ ਤਾਂ ਘੱਟੋ ਘੱਟ ਹੋਣੇ ਚਾਹੀਦੇ ਨੇ ਉਹਨੂੰ ਉਹ ਵੀ ਬੁਲਾਣੇ ਨੇ ਕੋਈ ਦੋ ਚਾਰ ਹੋਰ ਹੋਣਗੇ ਇਕ ਚਾਂਡੀ ਘਰੇ ਦੇ ਆਵਾਂਗੇ ਕੋਈ ਕੰਮ ਵਾਲੀ ਲਾ ਲਈਏ ਇੱਕ ਅੱਧੀ ਜਿਹੜਾ ਕਰ ਜਾਵੇ ਉਹ ਬਣਾ ਜਾਵੇ ਖਾਣਾ ਹਾਂ ਰਾਤ ਨੂੰ ਹਾਂ ਰਾਤ ਨੂੰ ਵੀ ਚਲ ਜਾਏਗਾ ਫਿਰ ਅਗਲੇ ਦਿਨ ਤੋਂ ਕਿਤੇ ਹੋ ਜਾਏਗਾ ਫਿਰ ਉਹੀਓ ਰੋਟੀ ਅਤੇ ਉਹੀਓ ਦਾਲ ਉਹੀਓ ਅਚਾਰ ਹਮ ਮੂਲੀ ਮੂਲੀ ਪਰੌਂਠੇ ਅਤੇ ਇਹ ਇੱਕ ਇੱਕ ਆ ਜਿਹੜੀ ਆਪਣੇ ਪੜੋਸੀਆਂ ਦੇ ਨਹੀਂ ਆਉਂਦੀ ਕੁੜੀ ਛੋਟੀ ਜੀ ਇਹਨੂੰ ਦੋ ਤਿੰਨ ਦਿਨ ਵਾਸਤੇ ਆਇਆ ਜੀ ਕਰ ਲਿਆ ਤੇਰਾ ਸਮਾਨ ਸਮੁਨ ਸਾਰਾ ਜੋੜ ਦੇਗੀ ਮੂ ਮੂਰਤੀ ਮੁ ਆ ਜਾਏਗੀ ਮੂਰਤੀ ਹਾਂ ਉਹ ਨਾ ਆਵੇ ਤਾਂ ਫਿਰ ਇਹਨੂੰ ਪਕੜ ਲਈ ਦੋ ਕੁ ਦਿਨ ਥੋੜ੍ਹੀ ਸਸਤੀ ਹੋ ਜਾਏਗੀ ਸਾਰਾ ਦਿਨ ਰੱਖ ਲੀ ਭਾਵੇਂ ਸ਼ਾਮ ਨੂੰ ਛੱਡ ਆਵਾਂਗੇ ਇਹਨੂੰ ਘਰੇ ਬਸ ਘਰ ਇਹਦਾ ਨੇੜੇ ਤੇੜੇ ਹੈਗੀ ਕਿਧਰੇ ਵਾਲੇ ਪਾਸੇ ਅਤੇ ਉੱਧਰ ਫਿਰ ਹੋਰ ਕੋਈ ਖਾਸ ਗੱਲ ਸਮਾਨ ਬਾਅਦ ਵਿਚ ਪਹਿਲੇ ਕੀ ਉਹ ਘੜਾ ਭਰ ਕੇ ਰੱਖੀਦਾ ਕਲਸ਼ ਫੇਰ ਉਸੇ ਦਿਨ ਸਮਾਨ ਕਿ ਅਗਲੇ ਦਿਨ ਸਮਾਨ ਹਮ ਉਹ ਤਾਂ ਕਹਿੰਦੇ ਨੇ ਸਵਾ ਮਹੀਨਾ ਲੋਕ ਨਹੀਂ ਕਰੀਦਾ ਮਕਾਨ ਜਿਹੜਾ ਉਸ ਕਰੀਏ ਨਾ ਸਵਾ ਹੈਂ ਅੱਛਾ ਹਮ ਚਲੋ ਠੀਕ ਹੈ ਜੀ ਠੀਕ ਓਕੇ